ਅਲੱਗ ਜਾਨਵਰਾਂ ਦੇ ਉਤਪਾਦ ਪੈਦਾ ਕਰਨ ਜਿੱਕਣ ਆਪਾਂ ਇਹ ਆਪਾਂ ਹੁਣ ਚੂੱਚੇ ਪਾਲਦੇ ਹਨ ਉਹਨੂੰ ਵਧੀਆ ਤਰੀਕੇ ਨਾਲ ਉਹਦੀ ਖੁਰਾਕ ਪਾਣੀ ਦਿੰਦੇ ਹਾਂ ਤਾਂ ਸਹੀ ਤਰੀਕੇ ਨਾਲ ਉਹਨੂੰ ਪਾਲਦੇ ਪੋਸ਼ਦੇ ਹਾਂ ਫਿਰ ਉਸ ਦੇ ਬਾਅਦ ਉਹਨੂੰ ਅੱਗੇ ਵੱਢਣ ਵੱਢ ਟੁੱਕ ਕਰਨ ਵਾਸਤੇ ਸਾਫ਼ ਸੁਥਰਾ ਕਰਕੇ ਤਾਂ ਕਸਾਈ ਉਹਨੂੰ ਵੇਚਦਾ ਵਧੀਆ ਰੇਟ ਦੇ ਹਿਸਾਬ ਨਾਲ ਤਾਂ ਜੋ ਕਿ ਉਸਦਾ ਖਰੀਦ ਕ ਅੱਗੇ ਕਰ ਸਕਣ